ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਭਗਤ ਸਿੰਘ ਜੀ ਦੇ ਨਾਂ ਤੋਂ ਪਿਆ ਹੈ ਇੱਥੋਂ ਦੀ ਬਹੁਤ ਸਥਾਨਕ ਕਲਾ ਅਤੇ ਸ਼ਿਲਪਕਾਰੀ ਮਸ਼ਹੂਰ ਹਨ ਖਾਲਸਾ ਸਿਲਕ ਸਟੋਰ ਤੋਂ ਕਾਫ਼ੀ ਫੁਲਕਾਰੀਆਂ ਬਾਹਰ ਨੂੰ ਭੇਜੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਸਥਾਨਕ ਕਲਾ ਅਤੇ ਸ਼ਿਲਪਕਾਰੀ ਮਸ਼ਹੂਰ ਹਨ